ਹੁਣ ਤੱਕ ਖੇਡਾਂ ਨੇ ਸਾਰੇ ਲੋਕਾਂ 'ਤੇ ਵਧੀਆ ਪ੍ਰਭਾਵ ਪਾਇਆ ਹੋਇਆ ਏ ਬਟ ਹੋਰ ਪੌਜ਼ੀਟਵ ਪ੍ਰਭਾਵ ਪਾਉਣ ਲਈ ਖਿਡਾਰੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਕੋਈ ਵੀ ਖੇਡ ਨੂੰ ਮੰਨੋਰੰਜਨ ਤੌਰ 'ਤੇ ਲੈਣ ਨਾ ਕਿ ਕੋਈ ਵੈਰ ਭਾਵਨਾ ਨਾਲ ਖੇਡਣ ਤਾਂ ਜੋ ਕੋਈ ਵੀ ਜਿੱਤ ਦੀ ਚਾਹ ਵਿੱਚ ਕਿਸੇ ਵੀ ਖਿਡਾਰੀ ਨੂੰ ਇੱਦਾਂ ਦਾ ਨੁਕਸਾਨ ਨਾ ਹੋਵੇ ਕਿ ਉਹ ਆਪਣੀ ਜ਼ਿੰਦਗੀ ਹੀ ਗਵਾ ਬੈਠੇ ਅਤੇ ਦੂਸਰਾ ਉਹ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰੇ ਤਾਂ ਦੂਸਰਾ ਲੋਕ ਉਸ ਦਾ ਸਤਿਕਾਰ ਕਰਨ ਅਤੇ ਆਪਾਂ ਨੂੰ ਸਾਰਿਆਂ ਨੂੰ ਖੇਡਾਂ ਦਾ ਵਧੀਆ ਟੂਰਨਾਮੈਂਟ ਕਰਵਾਉਣਾ ਚਾਹੀਦਾ ਹੈ ਅਤੇ ਜੋ ਵੀ ਖਿਡਾਰੀ ਹੈ ਉਸਨੂੰ ਜੋ ਵੀ ਖਿਡਾਰੀ ਜਿੱਤਦਾ ਹੈ ਉਸ ਨੂੰ ਵਧੀਆ ਇਨਾਮ ਦੇਣਾ ਚਾਹੀਦਾ ਹੈ ਅਤੇ ਉਸਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਨਵੇਂ ਨੌਜਵਾਨ ਹਨ ਉਹ ਬ ਖੇਡਾਂ ਵਿੱਚ ਆਉਣ ਅਤੇ ਨੈਸ਼ਨਲ ਲੈਵਲ ਦੇ ਜੋ ਖਿਡਾਰੀ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਅਨੁਸਾਰ ਬਣਦਾ ਇਨਾਮ ਦਿੱਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਨੌਕਰੀ ਜਾਂ ਪੈਸੇ ਦੀ ਮੇ ਸਪੋਰਟ ਕਰਨੀ ਚਾਹੀਦੀ ਹੈ